ਮੈਂ ਆਮ ਤੌਰ 'ਤੇ ਹਰ ਹਫ਼ਤੇ ਨੇੜਲੇ ਕਸਬਿਆਂ ਅਤੇ ਪਿੰਡਾਂ ਦਾ ਦੌਰਾ ਕਰਦਾ ਹਾਂ ਕਈ ਵਾਰ ਮੈਂ ਦੋਸਤਾਂ ਅਤੇ ਪਰਿਵਾਰ ਨੂੰ ਮਿਲਣ ਜਾਂਦਾ ਹਾਂ ਖ਼ਾਸ ਕਰਕੇ ਜਦੋਂ ਕੋਈ ਤਿਉਹਾਰ ਜਾਂ ਵਿਆਹ ਹੋਵੇ ਮੈਂ ਕਈ ਵਾਰ ਖੇਤੀਬਾੜੀ ਨਾਲ ਜੁੜੇ ਕੰਮ ਕਰਨ ਲਈ ਵੀ ਜਾਂਦਾ ਹਾਂ ਕਿਉਂਕਿ ਮੇਰਾ ਪਰਿਵਾਰ ਦੇ ਕੁਝ ਲੋਕ ਅਜਿਹੇ ਵੀ ਪਿੰਡਾਂ ਵਿੱਚ ਖੇਤੀ ਕਰਦੇ ਹਨ ਇਸ ਤੋਂ ਇਲਾਵਾ ਅਗਰ ਮੈਂ ਕਿਸੇ ਵੀ ਆਲੇ ਦੁਆਲੇ ਦੇ ਪਿੰਡ ਵਿੱਚ ਜਾਣਾ ਹਾਂ ਤਾਂ ਮੈਂ ਕਈ ਵਾਰ ਤਾਂ ਸਿਰਫ਼ ਘੁੰਮਣ ਅਤੇ ਕੁਦਰਤੀ ਮਾਹੌਲ ਦਾ ਆਨੰਦ ਲੈਣ ਜਾਂਦਾ ਹਾਂ ਕਿਉਂਕਿ ਉਸ ਕਰਕੇ ਮੇਰਾ ਬਹੁਤ ਸਾਰਾ ਸਟਰੈਸ ਘੱਟ ਹੋ ਜਾਂਦਾ ਹੈ ਤਾਂ ਕਿਉਂਕਿ ਸ਼ਹਿਰ ਦੀ ਭੱਜ ਦੌੜ ਭਰੀ ਜ਼ਿੰਦਗੀ ਤੋਂ ਦੂਰ ਪਿੰਡਾਂ ਵਿੱਚ ਸ਼ਾਂਤੀ ਮਿਲਦੀ ਹੈ ਅਤੇ ਉੱਥੇ ਜਾ ਕੇ ਦਿਲ ਅਤੇ ਸਰੀਰ ਨੂੰ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਹੈ